ਜਦੋਂ ਸਾਡੇ ਘਰ ਵਿੱਚ ਕੋਈ ਪ੍ਰੋਗਰਾਮ ਆਉਂਦਾ ਹੈ ਚਾਹੇ ਉਹ ਕਿਸੇ ਦਾ ਜਨਮਦਿਨ ਹੋਵੇ ਜਾਂ ਵਿਆਹ ਹੋਵੇ ਜਾਂ ਘਰ ਵਿੱਚ ਮਹਾਰਾਜ ਜੀ ਦਾ ਪਾਠ ਕਰਵਾਇਆ ਗਿਆ ਹੋਵੇ ਤਾਂ ਸਾਡਾ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਜੇ ਸਾਡੇ ਘਰ ਵਿੱਚ ਕਿਸੇ ਦਾ ਜਨਮ ਦਿਨ ਮਨਾਉਣਾ ਹੁੰਦਾ ਹੈ ਤਾਂ ਸਾਡਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ ਅਤੇ ਪਹਿਲਾਂ ਤਾਂ ਅਸੀਂ ਗੁਰੂ ਘਰ ਜਾਂਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਵਾ ਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਹਾਂ ਅਤੇ ਬਾਅਦ ਵਿੱਚ ਸਾਰੇ ਖਾਣ ਪੀਣ ਕਰਦੇ ਹਾਂ ਅਤੇ ਸ਼ਾਮ ਵੇਲੇ ਜਨਮ ਦਿਨ ਦਾ ਕੇਕ ਕੱਟਿਆ ਜਾਂਦਾ ਹੈ ਵਿਆਹ ਵਿੱਚ ਵ ਵੀ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਤਿੰਨ ਤੋਂ ਚਾਰ ਦਿਨ ਇਕੱਠੇ ਰਹਿੰਦੇ ਹਾਂ